ਲਚਕਤਾ ਵਧਾਉਣ ਵਿੱਚ ਜਿਹੜੇ ਆਸਣ ਨੇ ਉਹ ਤਾਂ ਕਾਫ਼ੀ ਜ਼ਿਆਦਾ ਨੇ ਉਹਨਾਂ ਦੀ ਸੂਚੀ ਕਾਫ਼ੀ ਲੰਬੀ ਹੈ ਪਰ ਮੈਂ ਜਿਹੜੇ ਮੁੱਖ ਮੁੱਖ ਦੋ ਚਾਰ ਆਸਣ ਨੇ ਉਹਨਾਂ ਬਾਰੇ ਦੱਸ ਸਕਦੀ ਹਾਂ ਜਿਵੇਂ ਧਿਆਨ ਅਤੇ ਧਾਰਨਾ ਦਾ ਜਿਹੜਾ ਅਭਿਆਸ ਕਰਨਾ ਉਹ ਵੀ ਲਚਕਤਾ ਵਧਾਉਣ ਵਿੱਚ ਕਾਫ਼ੀ ਮਹੱਤਵਪੂਰਨ ਆ ਅਤੇ ਕਾਫ਼ੀ ਸਹਾਇਤਾ ਕਰਦਾ ਧਿਆਨ ਲਗਾਉਣ ਦਾ ਮਤਲਬ ਹੈ ਕਿ ਮਨ ਨੂੰ ਇੱਕ ਸਥਿਤੀ 'ਤੇ ਕੇਂਦਰਿਤ ਕਰਨਾ ਧਾਰਨ ਰੱਖਣਾ ਧਾਰਨਾ ਦਾ ਮਤਲਬ ਆ ਕਿ ਕਰਨਾ ਕੀ ਆ ਮਨ ਨੂੰ ਸਥਿਰ ਕਰਨਾ ਅਤੇ ਇੱਕ ਵਹਿਜਾ ਬਣਾਉਣ ਦਾ ਸੁਝਾਅ ਦਿੱਤਾ ਇਹ ਲਚਕਤਾ ਦੀ ਸਥਿਤੀ ਵਿੱਚ ਮਦਦ ਕਰਦਾ ਇਸ ਤੋਂ ਇਲਾਵਾ ਨਵੀਨਤਾ ਅਤੇ ਨਵ ਚੇਤਨਾ ਵਰਤਣਾ ਇਹ ਵੀ ਲਚਕਤਾ ਵਧਾਉਣ ਦੇ ਲਈ ਮੁੱਖ ਜਿਹੜੇ ਹੈਗੇ ਨੇ ਉਹ ਸਿਖਰ ਨੇ ਨਵੀਨਤਾ ਮਤਲਬ ਆ ਵੀ ਨਵੇਂ ਵਿਚਾਰਾਂ ਜਾਂ ਸੁਝਾਵਾਂ ਨੂੰ ਸਵੀਕਾਰ ਕਰਨਾ ਕਿ ਅਸੀਂ ਕਰਨਾ ਕੀ ਆ ਇਹਦੇ ਨਾਲ ਵੀ ਵਕਤ ਦੇ ਜਿਹੜੀਆਂ ਸੰਭਾਵਨਾਵਾਂ ਨੇ ਉਹ ਵੱਧ ਜਾਂਦੀਆਂ ਨੇ ਅਤੇ ਵਿਅਕਤੀ ਆ ਜਿਹੜਾ ਉਹ ਨਵੀਨ ਹੋਣ ਦਾ ਆਨੰਦ ਆ ਜਿਹੜਾ ਉਹ ਫੀਲ ਕਰਦਾ ਅਤੇ ਉਹ ਆਪਣੇ ਹੌਜ ਨੂੰ ਸ਼ੇਅਰ ਕਰਨ ਦੀ ਹੱਦ ਵਰਤਦਾ ਇਸ ਤੋਂ ਇਲਾਵਾ ਜਿਵੇਂ ਸਮਰਥਨ ਕਰਨਾ ਕਿਸੇ ਦਾ ਜਾਂ ਟੀਮ ਦੇ ਵਿੱਚ ਵਰਕ ਕਰਨਾ ਇਹ ਵੀ ਲਚਕਤਾ ਵਧਾਉਣ ਦੇ ਲਈ ਬੇਹੱਦ ਮਹੱਤਵਪੂਰਨ ਹੈ